ਮੇਰਾ ਸਭ ਤੋਂ ਵਧੀਆ ਐਕਸਪੀਰੀਐਂਸ ਔਨਲਾਈਨ ਤੋਂ ਮੰਗਾਉਣ ਦਾ ਇਲੈਕਟ੍ਰੋਨਿਕਸ 'ਚ ਮੇਰੇ ਹੈੱਡਫੋਨਸ ਹੈਗੇ ਸੀ ਜਿਹੜੇ ਮੈਂ ਫਲਿੱਪਕਾਰਟ ਤੋਂ ਔਡਰ ਕੀਤੇ ਸੀ ਬੋਟ ਕੰਪਨੀ ਦੇ ਬਟ ਉਹ ਬਹੁਤ ਹੀ ਜ਼ਿਆਦਾ ਵਧੀਆ ਸੀ ਅਤੇ ਉਹਦੀ ਮਿਊਜ਼ਿਕ ਸਿਸਟਮ ਉਹਦੇ ਕੰਫਰਟ ਵਿਦ ਮਾਈ ਮ ਮੇਰੇ ਕੰਨਾਂ 'ਚ ਬਹੁਤ ਕੰਫਰਟੇਬਲ ਫੁੱਟ ਹੋਏ ਹੈ ਬਹੁਤ ਵਧੀਆ ਸਾਊਂਡ ਸਿਸਟਮ ਹੈਗਾ ਸੀ ਅਤੇ ਬਹੁਤ ਹੀ ਜ਼ਿਆਦਾ ਮੇਰੇ ਕੰਨ ਕਦੇ ਦੁਖੇ ਨਹੀਂ ਉਹਦੇ ਨਾਲ ਅਤੇ ਬਹੁਤ ਵਧੀਆ ਐਕਸਪੀਰੀਐਂਸ ਰਿਹਾ ਅਤੇ ਉਹ ਜਦੋਂ ਵੀ ਮੈਂ ਕਿਤੇ ਟਰੈਵਲ ਕਰਨਾ ਹੁੰਦਾ ਮੈਂ ਕਿਤੇ ਜਾਣਾ ਹੁੰਦਾ ਅਤੇ ਮੈਂ ਕਿਤੇ ਵੀ ਫ੍ਰੀ ਟਾਈਮ ਬੈਠਣਾ ਹੋਵੇ ਤਾਂ ਮੈਂ ਆਪਣੇ ਹੈੱਡਫੋਨਸ ਕੱਢ ਕੇ ਲਗਾ ਕੇ ਆਪਣਾ ਮਿਊਜ਼ਿਕ ਸੁਣਦੀ ਹਾਂ ਅਤੇ ਬਹੁਤ ਹੀ ਜ਼ਿਆਦਾ ਸੂਦਿੰਗ ਬਹੁਤ ਹੀ ਵਧੀਆ ਮਾਹੌਲ ਬਣਾ ਕੇ ਬਹੁਤ ਵਧੀਆ ਲੱਗਦਾ ਹੈਗਾ ਬਹੁਤ ਸਭ ਤੋਂ ਮੇਨ ਉਹਦੀ ਹੈੱਡਫੋਨਸ ਦੀ ਐਬ ਹੈਗੀ ਹੈ ਕਿ ਉਹ ਬਹੁਤ ਹੀ ਜ਼ਿਆਦਾ ਮੇਰੇ ਕੰਨਾਂ 'ਚ ਬਹੁਤ ਜ਼ਿਆਦਾ ਕੰਫਰਟੇਬਲ ਹੈਗੇ ਹੈ ਅਤੇ ਬਹੁਤ ਵਧੀਆ ਹੈਗੇ ਹੈ ਇੱਕ ਉਹਨਾਂ ਦਾ ਮਿਊਜ਼ਿਕ ਸੁਣਨ ਦਾ ਮੇਰੇ ਕੰਨ ਨੂੰ ਨਹੀਂ ਵੱਜਦੇ ਅਤੇ ਬਹੁਤ ਜ਼ਿਆਦਾ ਕੰਪਨੀ ਦਾ ਵੀ ਹੈ ਉੱਦਾਂ ਸੁਣਿਆ ਸੀ ਕਿ ਪ੍ਰੋਡਕਟਸ ਅੱਛੇ ਨਹੀਂ ਹੁੰਦੇ ਬਟ ਮੇਰਾ ਜੋ ਬੈਸਟ ਐਕਸਪੀਰੀਐਂਸ ਹੈਗਾ ਇਲੈਕਟ੍ਰੋਨਿਕਸ 'ਚ ਹੈਗਾ ਅਤੇ ਬਹੁਤ ਵਧੀਆ ਹੈੱਡਫੋਨਸ ਨਿਕਲੇ ਉਹਦੇ ਅਤੇ ਬਹੁਤ ਅੱਛੀ ਪੈਕਿੰਗ ਹੈਗੀ ਸੀ ਅਤੇ ਐਕਸਪੀਰੀਐਂਸ ਬਹੁਤ ਵਧੀਆ ਹੁਣ ਤੱਕ ਵੀ ਮੈਂ ਬਹੁਤ ਖੁਸ਼ ਹੋ ਕੇ ਉਹਨਾਂ ਨੂੰ ਯੂਜ਼ ਕਰਦੀ ਹਾਂ ਅਤੇ ਕਾਫ਼ੀ ਅੱਛੇ ਹਲੇ ਤੱਕ ਚੱਲ ਰਹੇ ਆ ਮੈਨੂੰ ਕਾਫ਼ੀ ਟਾਈਮ ਹੋ ਗਿਆ ਬਟ ਹਾਲੇ ਵੀ ਮੈਨੂੰ ਉਹਨਾਂ 'ਚੋਂ ਹੈਡਫੋਨਸ 'ਚ ਕੋਈ ਦਿੱਕਤ ਨਹੀਂ ਆਈ ਅਤੇ ਬਹੁਤ ਵਧੀਆ ਚੱਲਦੇ ਰਹੇ ਹੈ ਮੇਰੇ ਹਾਲੇ ਵੀ ਮੈਂ ਕਹਾਂਗੀ ਮੈਨੂੰ ਇਹ ਕਾਫ਼ੀ ਬੈਸਟ ਪ੍ਰੋਡਕਟ ਨਿਕਲਿਆ ਹੈਗਾ